ਅਡੋਲਫ ਹਿਟਲਰ ਨਪੋਲੀਅਨ ਇਬਰਾਹਿਮ ਲਿੰਕਨ ਜੋਰਜ ਵਾਸ਼ਿੰਗਟਨ ਐਲਬਰਟ ਪੀ ਟੀ ਊਸ਼ਾ ਮਹਾਤਮਾ ਗਾਂਧੀ ਵਿਲੀਅਮ ਸ਼ੇਕਸਪੇਅਰ ਹੈਨਰੀ ਯੂਸਫ ਸਟੇਲਿਨ ਕੁਈਨ ਵਿਕਟੋਰੀਆ ਐਮੀਲੀਆ ਔਗਸਟਸ ਜੇਨ ਔਗਸਟਨ ਮੁਹੰਮਦ ਜੋਸਫ ਸਟੈਲਿੰਗ